ਅੱਜ ਦੇ ਟਾਈਮ ਵਿੱਚ ਮੇਰੀ ਰਸੋਈ ਵਿੱਚ ਬਹੁਤ ਸਾਰੇ ਬਿਜਲੀ ਦੇ ਉਪਕਰਨ ਹਨ ਮਿਕਸਰ ਹੈ ਚੌਪਰ ਹੈ ਇਲੈਕਟ੍ਰੋਨਿਕ ਕੈਟਲ ਹੈ ਇੰਡਕਸ਼ਨ ਹੈ ਇਲੈਕਟ੍ਰੋਨਿਕ ਕੁੱਕਰ ਹੈ ਅਜਿਹਾ ਲੱਗਦਾ ਨਹੀਂ ਮੈਨੂੰ ਕੋਈ ਉਪਕਰਨ ਹੈ ਕਿ ਜਿਹੜਾ ਮੇਰੀ ਰਸੋਈ ਵਿੱਚ ਨਹੀਂ ਸ਼ਾਮਿਲ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੇ ਮਮੀ ਨੇ ਚਟਨੀ ਬਣਾਉਣ ਲਈ ਮੈਨੂੰ ਕੁੰਡੀ ਦੇ ਦੇਣੀ ਓ ਉਸਦੇ ਵਿੱਚ ਬਹੁਤ ਟਾਈਮ ਲੱਗਦਾ ਸੀ ਫਿਰ ਕਈ ਵਾਰ ਮੇਰੀ ਮੰਮੀ ਨੇ ਕਸਰ ਕੱਦੂਕਸ ਕਰਨ ਵਾਸਤੇ ਮੈਨੂੰ ਮਾਮੂਲੀ ਕੁਤਰਾ ਦੇ ਦੇਣਾ ਜਿਹਦੇ 'ਚ ਵੀ ਜੀ ਬਹੁਤ ਟਾਈਮ ਲੱਗਦਾ ਸੀ ਲੇਕਿਨ ਹੁਣ ਤਾਂ ਮੇਰੇ ਕੋਲ ਫੂਡ ਪ੍ਰੋਸੈਸਰ ਹੈ ਜਿਸ ਵਿੱਚ ਮੈਂ ਮਿੰਟਾਂ 'ਚ ਗਾਜਰਾਂ ਕਰ ਲੈਂਦੀ ਹਾਂ ਝੱਟ ਕਈ ਘੰਟਿਆਂ ਦਾ ਕੰਮ ਜਿਹੜਾ ਮਿੰਟਾਂ ਵਿੱਚ ਹੋ ਜਾਂਦਾ ਹੈ ਮੈਂ ਹਰ ਤਰ੍ਹਾਂ ਦੇ ਮਸਾਲੇ ਘਰ ਵਿੱਚ ਪੀਸਦੀ ਹਾਂ ਮੈਂ ਕੋਈ ਵੀ ਮਿਸਾਲਾਂ ਬਾਜ਼ਾਰ ਤੋਂ ਨਹੀਂ ਲੈਂਦੀ ਮੈਂ ਸਾਬੂਤ ਮਸਾਲੇ ਲੈ ਕੇ ਆਉਂਦੀ ਹਾਂ ਫਿਰ ਉਹਨਾਂ ਨੂੰ ਖੁਦ ਪੀਸਦੀ ਹਾਂ ਜਿਸ ਦੇ ਨਾਲ ਸਬਜ਼ੀ ਦਾ ਸਵਾਦ ਵੀ ਵਧੀਆ ਆਉਂਦਾ ਹੈ ਅਤੇ ਹੈਲਦੀ ਵੀ ਰਹਿੰਦਾ ਹੈ ਅਤੇ ਇਸ ਨਾਲ ਮੈਨੂੰ ਕਈ ਕੰਮ ਹਨ ਜਿਹੜੇ ਮੇਰੇ ਬਹੁਤ ਆਸਾਨ ਹੋ ਗਏ ਹਨ ਜਿਵੇਂ ਤੁਸੀਂ ਚਾਵਲ ਬਣਾਓ ਤਾਂ ਉਹਨੂੰ ਗਰਮ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਹੁਣ ਓਵਨ ਦੀ ਮਦਦ ਨਾਲ ਅਸੀਂ ਠੰਢੇ ਚਾਵਲਾਂ ਨੂੰ ਵੀ ਗਰਮ ਕਰਕੇ ਖਾਂਦੇ ਹਾਂ ਮਿੱਠੀ ਚੀਜ਼ ਖਾਣੀ ਆ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰਕੇ ਖਾ ਸਕਦੇ ਹੋ ਗਰਮ ਗੁਲਾਬ ਜਾਮੁਣ ਗਰਮ ਕਰਕੇ ਕਰ ਸਕਦੇ ਹੋ ਇਸ ਦੇ ਨਾਲ ਔਰਤ ਦੀ ਜ਼ਿੰਦਗੀ ਵਿੱਚ ਕਈ ਆਸਾਨੀਆਂ ਆ ਗਈਆਂ ਹਨ ਜਿਹੜਾ ਕੰਮ ਕਰਨ ਵਾਸਤੇ ਉਹਨਾਂ ਨੂੰ ਘੰਟੇ ਮਿਹਨਤ ਕਰਨੀ ਪੈਂਦੀ ਸੀ ਉਹ ਕੰਮ ਸਾਡੇ ਮਿੰਟਾਂ ਵਿੱਚ ਹੋ ਜਾਂਦੇ ਹਨ ਜਿਹੜਾ ਕੰਮ ਔਰਤਾਂ ਪੂਰਾ ਪੂਰਾ ਦਿਨ ਲਗਾ ਦਿੰਦੀਆਂ ਸੀ ਉਹ ਕੰਮ ਅਸੀਂ ਕੁਝ ਹੀ ਘੰਟਿਆਂ ਵਿੱਚ ਕਰਕੇ ਆਪਣੇ ਕੰਮ ਤੋਂ ਵੇਹਲੇ ਹੋ ਜਾਂਦੇ ਹਨ ਇਸ ਨਾਲ ਸਾਡੀ ਲਾਈਫ ਬੜੀ ਸੌਖਾਲੀ ਹੋ ਗਈ ਹੈ ਧੰਨਵਾਦ